ਪਹਿਲਾਂ ਬਹੁਤ ਹੀ ਜ਼ਿਆਦਾ ਮੈਂ ਅਖਬਾਰ ਪੜ੍ਹਦਾ ਹੁੰਦਾ ਸੀ ਅਤੇ ਟੀ ਵੀ ਦੇਖਦਾ ਹੁੰਦਾ ਸੀ ਫਿਰ ਜਦੋਂ ਇਹ ਕਿਸਾਨ ਅੰਦੋਲਨ ਚੱਲਿਆ ਜਿਸ ਵਿੱਚ ਹਰਿਆਣਾ ਪੰਜਾਬ ਯੂਪੀ ਇਹਨਾਂ ਵੱਖ ਵੱਖ ਸਟੇਟਾਂ ਨੇ ਸਾਡੇ ਸ ਕਿਸਾਨਾਂ ਦਾ ਸਾਥ ਦਿੱਤਾ ਅਤੇ ਇੱਥੇ ਹੀ ਮੀਡੀਆ ਦਾ ਇੰਡੀਆ ਦਾ ਅਸਲੀ ਰੂਪ ਸਾਹਮਣੇ ਆਇਆ ਹੈ ਕਿਉਂਕਿ ਉਹ ਜੋ ਕਿ ਅਸਲੀ ਸੱਚ ਦਿਖਾਉਣਾ ਸੀਗਾ ਕਿਸਾਨ ਕਿਸ ਮਕਸਦ ਲਈ ਬੈਠੇ ਹਨ ਅਤੇ ਕੀ ਕਰ ਰਹੇ ਹਨ ਕਿਹੜੀਆਂ ਉਹਨਾਂ ਨੂੰ ਉੱਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੀ ਉਹ ਕੁਛ ਵੀ ਨਹੀਂ ਦਿਖਾ ਰਹੇ ਸੀ ਉਹ ਸਿਰਫ ਦਿਖਾ ਰਹੇ ਸੀ ਵੀ ਧਰਮ ਬਾਰੇ ਇਹ ਖਾਲਿਸਤਾਨੀ ਬੈਠੇ ਆਂ ਜੀ ਇਹ ਹਿੰਦੁਸਤਾਨੀ ਹੈ ਜੀ ਇਹ ਆਂਏ ਹੈ ਇਹ ਦੇਸ਼ ਨੂੰ ਲੜਾਉਣਾ ਚਾਹੁੰਦੇ ਹੈ ਜੀ ਇਹ ਹੈ ਵੋਹ ਹੈ ਉਸ ਵਕਤ ਮੇਰਾ ਇੰਡੀਆ ਮੀਡੀਆ ਤੋਂ ਜਮ੍ਹਾਂ ਹੀ ਭਰੋਸਾ ਟੁੱਟ ਚੁੱਕਿਆ ਸੀ ਅਤੇ ਮੈਂ ਇੱਥੋਂ ਤੱਕ ਮੈਂ ਆਪਣੇ ਅਖਬਾਰ ਲਗਾਇਆ ਹੋਇਆ ਸੀਗਾ ਘਰਾਂ ਉਹ ਵੀ ਬੰਦ ਕਰਤਾ ਮੈਂ ਜਿੰਨੇ ਵੀ ਇਹ ਚਾਰ ਪੰਜ ਚੈਨਲ ਸੀਗੇ ਜੋ ਕਿ ਲਗਭਗ ਲਗਭਗ ਸਰਕਾਰ ਨੇ ਖਰੀਦੇ ਹੋਏ ਸੀਗੇ ਇਹ ਚੈਨਲ ਜੋ ਕਿ ਸੈਂਟਰ ਦੀ ਸਰਕਾਰ ਹੈ ਇਹ ਵੀ ਮੈਂ ਆਪਣੇ ਘਰੋਂ ਟੀ ਵੀ 'ਚੋਂ ਕਟਵਾ ਦਿੱਤੇ ਸੀਗੇ ਚੈਨਲਾਂ 'ਚੋਂ ਕਿਉਂਕਿ ਇਹਨਾਂ ਇਹ ਜੋ ਕਿ ਅਸਲੀ ਮੁੱਦੇ ਹਨ ਉਹਨਾਂ 'ਤੇ ਨਹੀਂ ਆ ਰਹੇ ਸੀ ਇਹ ਸਿਰਫ ਧਰਮਾਂ ਦੇ ਪਿੱਛੇ ਪੈ ਰਹੇ ਸੀ ਤੋਂ ਸਾਡੇ ਕੁਛ ਮਸ਼ਹੂਰ ਚੈਨਲ ਹਨ ਜਿਵੇਂ ਟੀ ਵੀ ਜੀ ਏਟੀਨ ਐੱਨ ਡੀ ਟੀ ਵੀ ਔਰ ਦੋ ਤਿੰਨ ਹੋਰ ਚੈਨਲ ਹਨ ਜਿਨ੍ਹਾਂ ਵਿੱਚ ਇਹ ਬਹੁਤ ਹੀ ਗਲਤ ਤਰੀਕੇ ਨਾਲ਼ ਸਹੀ ਚੀਜ਼ਾਂ ਨੂੰ ਇਹ ਗਲਤ ਕਰਕੇ ਦਿਖਾਉਂਦੇ ਹਨ ਜਿਸ ਨਾਲ਼ ਜਿਹੜਾ ਇਹਨਾਂ ਦਾ ਮੇਨ ਮੁੱਦਾ ਆਉਂਦਾ ਉਹ ਧਰਮ ਦਾ ਹੀ ਹੁੰਦਾ ਕੋਈ ਅਸਲੀ ਮੁੱਦਾ ਨਹੀਂ ਇਹ ਚੁੱਕਦੇ ਤਾਂ ਸਾਡੇ ਇੰਡੀਆ ਦਾ ਮੀਡੀਆ ਭਾਰਤ ਦਾ ਮੀਡੀਆ ਬੜਾ ਹੀ ਅੱਜ ਕੱਲ੍ਹ ਬੇਕਾਰ ਹੋ ਗਿਆ ਹੈ ਸਰਕਾਰਾਂ ਦੇ ਕਹੇ 'ਤੇ ਚੱਲਦਾ ਹੈ